ਇਸ ਸਮੇਂ ਕਾਫੀ ਤਕਨੀਕੀ ਚੁਣੌਤੀਆਂ ਮੁਸ਼ਕਿਲਾਂ ਖੜੀ ਕਰ ਰਹੀਆਂ ਹਨ ਜਿਵੇਂ ਕੀ ਤਕਨੀਕੀ ਹੁਨਰ ਦੀ ਕਮੀ ਜਿਹੜੇ ਵੀ ਲੋਕ ਇੰਡਸਟਰੀ ਦੇ ਵਿੱਚ ਜਾ ਰਹੇ ਨੇ ਉਹਨਾਂ ਦੇ ਅੰਦਰ ਤਕਨੀਕੀ ਹੁਨਰ ਨਹੀਂ ਹੈ ਜਿਹਦੇ ਕਾਰਨ ਜਿਹੜੀ ਵੀ ਕੰਪਨੀਜ਼ ਨਵੇਂ ਇਮਪਲੋਈਜ਼ ਰੱਖਣ ਦੀ ਕੋਸ਼ਿਸ਼ ਕਰ ਰਹੀਆਂ ਨੇ ਉਹਨਾਂ ਨੂੰ ਸਹੀ ਹੁਨਰ ਦੇ ਲੋਕ ਨਹੀਂ ਮਿਲ ਪਾ ਰਹੇ ਜਿਹਦੇ ਕਰਕੇ ਕੰਪਨੀਜ਼ ਨੂੰ ਆਪਣਾ ਕੰਮ ਅੱਗੇ ਵਧਾਉਣ ਵਿੱਚ ਕਾਫੀ ਜ਼ਿਆਦਾ ਦਿੱਕਤਾਂ ਆ ਰਹੀਆਂ ਹਨ ਇਸ ਤੋਂ ਬਾਅਦ ਲੋਕਾਂ ਦੇ ਵਿੱਚ ਸੰਚਾਰ ਹੁਨਰ ਦੀ ਵੀ ਕਮੀ ਹੈ ਸੰਚਾਰ ਹੁਨਰ ਦੀ ਕਮੀ ਹੋਣ ਕਰਕੇ ਜੋ ਵੀ ਕੰਪਨੀਜ਼ ਇਮਪਲੋਈਜ਼ ਨੂੰ ਕਲਾਇੰਟਸ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੀਆਂ ਹਨ ਉਹ ਮੁਸ਼ਕਿਲ ਹੋ ਜਾਂਦੀ ਹੈ ਉਹਦੇ ਕਰਕੇ ਜੋ ਵੀ ਪ੍ਰੋਜੈਕਟਸ 'ਤੇ ਉਹ ਕੰਮ ਕਰਦੇ ਨੇ ਉਹ ਹਮੇਸ਼ਾ ਡਿਲੇਅ ਹੋ ਜਾਂਦੇ ਨੇ ਇਸ ਚੀਜ਼ ਨੂੰ ਠੀਕ ਕਰਨ ਵਾਸਤੇ ਜਿਹੜੇ ਵੀ ਬੱਚੇ ਕੰਪਨੀਸ 'ਚ ਅਪਲਾਈ ਕਰ ਰਹੇ ਨੇ ਉਸ ਤੋਂ ਪਹਿਲਾਂ ਉਹਨਾਂ ਨੂੰ ਕੋਲਜ ਦੇ ਅੰਦਰ ਇਸ ਚੀਜ਼ ਦਾ ਪਤਾ ਹੋਣਾ ਚਾਹੀਦਾ ਹੈ ਅਤੇ ਇਹ ਸਭ ਕੁਛ ਉਹਨਾਂ ਦੀ ਡਿਗਰੀ ਦੇ ਅੰਦਰ ਵੀ ਦੱਸਣਾ ਚਾਹੀਦਾ ਹੈ ਕਿ ਉਹਨਾਂ ਨੂੰ ਕਿਸ ਤਰੀਕੇ ਦਾ ਹੁਨਰ ਦੀ ਲੋੜ ਹੈ ਜਿਹਦੇ ਨਾਲ ਉਹ ਕੰਪਨੀਸ ਨੂੰ ਫਾਇਦਾ ਕਰ ਸਕਣ ਤਕਨੀਕੀ ਹੁਨਰ ਅਤੇ ਸੰਚਾਰ ਹੁਨਰ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਇਸ ਤੋਂ ਬਾਅਦ ਕੁਛ ਸਕਿੱਲਸ ਵੀ ਹੈਗੀਆਂ ਨੇ ਜੋ ਬੱਚਿਆਂ ਨੂੰ ਆਉਣੀਆਂ ਚਾਹੀਦੀਆਂ ਨੇ ਜਦੋਂ ਉਹ ਕੰਪਿਊਟਰ ਬਾਰੇ ਸਿੱਖਦੇ ਨੇ ਤਾਂ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਵੀ ਕਿਹੜੀ ਕਿਹੜੀ ਐਪਲੀਕੇਸ਼ਨਸ ਯੂਸ ਕਰਨ ਨਾਲ ਉਹਨਾਂ ਨੂੰ ਕੰਮ ਕਰਨਾ ਜ਼ਿਆਦਾ ਸੌਖਾ ਹੋ ਜਾਏਗਾ ਜਿਹੜੇ ਵੀ ਬੱਚੇ ਅੱਜ ਕੱਲ੍ਹ ਆਪਣੀ ਕੰਪਨੀਸ ਵਿੱਚ ਅਪਲਾਈ ਕਰ ਰਹੇ ਨੇ ਉਹ ਜ਼ਿਆਦਾਤਰ ਮੁਸ਼ਕਿਲ ਸਕਿੱਲ ਸਿੱਖਦੇ ਨੇ ਅਤੇ ਮੁਸ਼ਕਿਲ ਸਕਿੱਲ ਸਿੱਖਣ ਤੋਂ ਬਾਅਦ ਉਹਨਾਂ ਨੂੰ ਕੰਪਨੀਜ ਦੇ ਵਿੱਚ ਜੋਬ ਨਹੀਂ ਮਿਲਦੀਆਂ